ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਨਾ ਮਤਲਬ ਕਿ ਇੱਥੋਂ ਗੁਰਦਾਸਪੁਰ ਤੋਂ ਬੋਲਦੇ ਪਏ ਹਾਂ ਅਤੇ ਸਾਡੇ ਇੱਧਰ ਨਾ ਬਾਰਿਸ਼ ਨਾਲ ਨਾ ਮਤਲਬ ਕਿ ਬਹੁਤ ਬੁਰਾ ਹਾਲ ਆ ਅਤੇ ਮਤਲਬ ਕਿ ਕਈਆਂ ਦੇ ਤਾਂ ਘਰ ਵੀ ਬਾਲਿਆਂ ਵਾਲੇ ਆ ਅਤੇ ਉਹਨਾਂ ਦੇ ਬਹੁਤ ਬੁਰਾ ਹਾਲ ਹੈ ਅਤੇ ਤੁਸੀਂ ਲੱਗੇ ਹੀ ਕਾਫੀ ਬਿਮਾਰੀਆਂ ਵਗੈਰਾ ਫੈਲ ਗਈਆਂ ਮਤਲਬ ਕਿ ਮੱਛਰ ਪਾਣੀ ਇਕੱਠਾ ਹੋ ਜਾਂਦਾ ਵੈ ਅਤੇ ਕਈਆਂ ਦਾ ਨੁਕਸਾਨ ਵੀ ਬਹੁਤ ਹੋਇਆ ਅਤੇ ਉਹਦੇ ਨਾਲ ਵੀ ਬਿਮਾਰੀਆਂ ਵੀ ਆ ਲੋਕ ਬਿਮਾਰ ਵੀ ਹੋ ਜਾਂਦੇ ਆ ਅਤੇ ਅਸੀਂ ਨ ਨਗਰ ਕੌਂਸਲ ਵਾਲਿਆਂ ਨਾਲ ਵੀ ਗੱਲ ਕੀਤੀ ਅਤੇ ਉਹਨਾਂ ਨੇ ਵੀ ਇਹੀ ਜੋ ਮਤਲਬ ਕਿ ਬੜਾ ਕੀਤਾ ਮੁਹੱਲਾ ਮੀਟਿੰਗ ਵਗੈਰਾ ਕਰਵਾਈਆਂ ਅਤੇ ਤੁਸੀਂ ਸਾਨੂੰ ਦੱਸੋ ਮਤਲਬ ਕਿ ਅਸੀਂ ਜਿੱਥੇ ਤੁਹਾਨੂੰ ਬੁਲਾਵਾਂਗੇ ਤੁਸੀਂ ਆ ਸਕਦੇ ਹੋ

ਅਸੀਂ ਇਸਲਾਮਾਬਾਦ ਦੇ ਹਾਂ ਅਤੇ ਉਹ ਇਹ ਗਲੀਆਂ ਵਾ ਉੱਥੇ ਪਾਣੀ ਵਗੈਰਾ ਖੜ੍ਹਾ ਹੋ ਜਾਂਦਾ ਗਾ ਅਤੇ ਉਹਦੇ ਨਾਲ ਕਾਫੀ ਸਮੱਸਿਆ ਆਉਂਦੀਆਂ ਕਈਆਂ ਦਾ ਤਾਂ ਮਤਲਬ ਕਿ ਸਮਾਨ ਵਗੈਰਾ ਵੀ ਗਿੱਲਾ ਹੋ ਜਾਂਦਾ ਵੈ ਅਤੇ ਉਹਦੇ ਨਾਲ ਕਿਉਂਕਿ ਮਤਲਬ ਕਿ ਲੋਕਾਂ ਦੇ ਘਰਾਂ 'ਚ ਵੀ ਪਾਣੀ ਆ ਜਾਂਦਾ ਗੰਦਾ ਪਾਣੀ ਆ ਜਾਂਦਾ ਵਾ ਅਤੇ ਸੀਵਰੇਜ ਦਾ ਵੀ ਪਾਣੀ ਮਤਲਬ ਕਿ ਨਾਲ ਇਕੱਠਾ ਹੋ ਜਾਂਦਾ ਬਾਰਿਸ਼ ਦੇ ਪਾਣੀ ਨਾਲ ਅਤੇ ਇਹਦੇ ਨਾਲ ਤੁਹਾਨੂੰ ਪਤਾ ਬਿਮਾਰੀਆਂ ਬਹੁਤ ਉਹਦੇ ਨਾਲ ਅਤੇ ਹੁਣ ਮਤਲਬ ਕਿ ਕਾਫੀ ਹੱਦ ਤੱਕ ਵਗੈਰਾ ਦਿੱਤੀਆਂ ਨਗਰ ਕੌਂਸਲ ਨਾਲ ਵੀ ਗੱਲ ਕੀਤੀ ਆ ਮਤਲਬ ਕਿ ਅਸੀਂ ਮੀਡੀਆ ਵਾਲੇ ਆਏ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਉਹ ਵੀ ਆ ਕੇ ਗਏ ਮਤਲਬ ਕਿ ਉਹਨਾਂ ਨੇ ਵੀ ਸਾਨੂੰ ਦੱਸਿਆ ਸੀ ਪਰ ਇਹ ਸਾਨੂੰ ਤੁਹਾਡਾ ਵੀ ਮਤਲਬ ਕਿ ਕੋ ਐਡਰੈਸ ਮਿਲਿਆ ਅਤੇ ਅਸੀਂ ਤੁਹਾਨੂੰ ਵੀ ਕੌਲ ਕੀਤੀ ਆ ਅਤੇ ਹਾਂਜੀ ਸਾਡਾ ਸਾਡਾ ਇਸਲਾਮਾਬਾਦ ਹੈ ਦੇ ਨਾਲ ਏ ਅਤੇ ਉੱਥੇ ਮਤਲਬ ਕਿ ਹਾਂਜੀ ਹੋਰ ਹਮ

ਅੱਛਾ ਚਲੋ ਜੀ ਠੀਕ ਹੈ ਫੇਰ ਧੰਨਵਾਦ ਜੀ ਤੁਹਾਡਾ ਅਤੇ ਤੁਸੀਂ ਮਤਲਬ ਕਿ ਇਹ ਤੁਹਾਨੂੰ ਅਡਰੈਸ ਭੇਜਤਾ ਤੁਸੀਂ ਉੱਥੇ ਪਹੁੰਚ ਸਕਦੇ ਹੋ ਠੀਕ ਹੈ ਓਕੇ